ਬਲਦੇਵ ਮਿਸਤਰੀ ਬੋਲਦਾ ਜੀ

ਹਾਂਜੀ ਹਾਂਜੀ ਸਾਈਜ਼ ਦੱਸ ਦਿਓ ਕਿੱਡਾ ਚਾਹੀਦਾ ਤੁਹਾਨੂੰ ਠੀਕ ਹੈ ਜੀ ਠੀਕ ਹੈ ਅਤੇ ਗੱਦੇ ਅਤੇ ਢੋਹ ਸਿੰਪਲ ਦੀ ਬਣਾਉਣੀ ਸਿੰਪਲ ਦੀ ਢੋਹ ਚਾਹੀਦੀ ਠੀਕ ਹੈ ਜੀ ਅਤੇ ਨਾਲ ਸਾ ਸਨਮਾਕਾ ਤੁਸੀਂ ਪਸੰਦ ਕਰ ਜਿਓ ਆ ਕੇ ਇਹ ਵੱਖ ਵੱਖ ਰੇਂਜ ਦਾ ਹੈ ਤੁਸੀਂ ਜਿਵੇਂ ਪਸੰਦ ਕਰੋਗੇ ਜਿਵੇਂ ਸਸਤੇ ਤੋਂ ਸਸਤਾ ਦਸ ਹਜ਼ਾਰ ਦਾ ਵੀ ਪੈ ਸਕਦਾ ਉਦੋਂ ਘੱਟ ਵੀ ਹੋ ਸਕਦਾ ਬਾਕੀ ਪੰਦਰ੍ਹਾਂ ਹਜ਼ਾਰ ਦਾ ਵੇ ਹੋ ਸਕਦਾ ਉਹ ਤੁਹਾਨੂੰ ਪੈ ਨਹੀਂ ਉਹਦੀ ਪੂਰੀ ਗਰੰਟੀ ਹੋਏਗੀ ਦੋ ਸਾਲ ਦੀ ਅਤੇ ਬਾਕੀ ਉਹ ਹੋਵੇਗਾ ਨਾਲ ਗੱਦੇ ਦੀ ਵੀ ਵਰੰਟੀ ਹੋਵੇਗੀ ਜੇ ਗੱਦਾ ਨਾਲ ਲਉਂਗੇ ਅਤੇ ਬਾਕੀ ਗੱਦੇ ਦੇ ਨਾਲ ਢੋਹ ਗੱਦੇ ਵੀ ਇੱਕ ਗੱਦਾ ਪੱਚੀ ਸੌ ਦਾ ਪੈ ਜਾਵੇਗਾ ਤੁਹਾਨੂੰ ਜੇ ਡਬਲ ਬੈਡ ਤਾਂ ਤੁਹਾਨੂੰ ਪੰਜ ਹਜ਼ਾਰ ਦਾ ਹੋ ਜਾਵੇਗਾ ਪੰਜ ਹਜ਼ਾਰ ਦਾ ਦੋਵੇਂ ਬੈਠਣਾ ਦਾ ਮਤਲਬ ਡਬਲ ਬੈਡ ਦਾ ਮਿਲਾ ਕੇ ਟੋਟਲ ਹਾਂਜੀ ਪੂਰਾ ਹੋਵੇਗਾ ਫਿਟਿੰਗ ਪੂਰੀ ਪੂਰੀ ਹੋਵੇਗੀ ਜਮਾਂ ਹਾਂਜੀ ਅਤੇ ਦਰਾਜ ਵਿੱਚ ਚਾਹੀਦੇ ਬੈਡ ਦੇ ਕਿ ਵੱਖਰੇ ਚਾਹੀਦੇ ਨਾਲ ਬੋਕਸ ਵੀ ਬਣ ਜਾਂਦੇ ਆ ਠੀਕ ਹੈ ਹਾਂਜੀ ਅੱਛਾ ਸਨੀ ਦੇ ਦਸ ਹਜ਼ਾਰ ਵਾਲਾ ਬੈਡ ਲਉਗੇ ਗੱਦਾ ਵਿੱਚ ਪਾ ਕੇ ਤੁਹਾਨੂੰ ਪੈ ਜਾਵੇਗਾ ਪੰਦਰ੍ਹਾਂ ਹਜ਼ਾਰ ਦਾ ਪੈ ਜਾਵੇਗਾ ਇਹ ਤੁਸੀਂ ਆ ਜਿਓ ਫਿਰ ਸਲਾਹ ਕਰ ਲਵਾਂਗੇ ਉਸ ਤੋਂ ਬਾਅਦ ਬਣ ਜੁਗਾ ਮਹੀਨੇ ਕ ਦੇ ਵਿੱਚ ਹਾਂਜੀ ਹਾਂਜੀ ਕੋਈ ਨਹੀਂ